ਮੈਂ ਮੈਂ ਕੁਝ ਸਾਲ ਪਹਿਲਾਂ ਇੱਕ ਇੱਕ ਪੇਂਟਿੰਗ ਬਣਾਈ ਸੀ ਜਿਹਦੇ ਵਿੱਚ ਇੱਕ ਟੀਚਰ ਹੈ ਉਹ ਬੱਚਿਆਂ ਨੂੰ ਪੜ੍ਹਾ ਰਹੀ ਸੀ ਅਗਰ ਮੈਨੂੰ ਕਦੇ ਮੌਕਾ ਮਿਲਦਾ ਹੈ ਕਿ ਮੈਂ ਕਿਸੇ ਪੇਂਟਿੰਗ ਵਿੱਚ ਕਦਮ ਰੱਖਾਂ ਉਹਦੀ ਉਹ ਉਸ ਨੂੰ ਜੀਵਾਂ ਅਤੇ ਉਹ ਇਹ ਵਾਲੀ ਪੇਂਟਿੰਗ ਹੋਏਗੀ ਕਿਉਂਕਿ ਜੋ ਪੜ੍ਹਾਉਣਾ ਹੈ ਉਹ ਸਭ ਤੋਂ ਇੱਕ ਚੰਗਾ ਕੰਮ ਹੈ ਇਸ ਸਮਾਜ ਵਿੱਚ ਸਭ ਤੋਂ ਚੰਗਾ ਕੰਮ ਹੈ ਕਿਸੇ ਨੂੰ ਪੜ੍ਹਾਉਣਾ ਕਿਸੇ ਨੂੰ ਸਿਖਾਉਣਾ ਕਿ ਕਿਆ ਚੰਗਾ ਹੈ ਕਿਆ ਬੁਰਾ ਹੈ ਅਤੇ ਜਿਵੇਂ ਹੁਣ ਮੈਂ ਮੈਂ ਵੀ ਬੀਐਡ ਕਰ ਰਹੀ ਹਾਂ ਮੈਨੂੰ ਅੱਗੇ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਬੱਚਿਆਂ ਨੂੰ ਜਿਹੜੇ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਹੀ ਆਪਣੇ ਆਉਣ ਵਾਲੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਹਨ ਉਹਨਾਂ ਨੇ ਆਪਣੇ ਸਮਾਜ ਨੂੰ ਸੰਭਾਲਣਾ ਹੈ ਇਸ ਲਈ ਬੱਚਿਆਂ ਨੂੰ ਸਿ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ ਇਸ ਕਰਕੇ ਜਿਹੜਾ ਜਿਵੇਂ ਜਿਵੇਂ ਮੈਂ ਇੱਕ ਪੇਂਟਿੰਗ ਬਣਾਈ ਸੀਗੀ ਜਿਹਦੇ ਵਿੱਚ ਇੱਕ ਮ ਟੀਚਰ ਹੈ ਉਹ ਬੱਚਿਆਂ ਨੂੰ ਪੜ੍ਹਾ ਰਹੀ ਹੈ ਬੱਚਿਆਂ ਨੂੰ ਸਮਝ ਰਹੀ ਹੈ ਅਤੇ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਮੈਂ ਮੈਂ ਵੀ ਚਾਹਵਾਂਗੀ ਕਿ ਜੋ ਬੱਚੇ ਮੇਰੇ ਕੋਲ ਪੜ੍ਹਨ ਉਹ ਉਹਨਾਂ ਨੂੰ ਮੈਂ ਉਹਨਾਂ ਦੇ ਹਰ ਉਹਨਾਂ ਦੀ ਮੈਂ ਉਹਨਾਂ ਦੀ ਕੁਆਲਿਟੀ ਨੂੰ ਸਮਝ ਸਕਾਂ ਅਤੇ ਉਹਨਾਂ ਦੀ ਦਿੱਕਤਾਂ ਨੂੰ ਵੀ ਸਮਝ ਸਕਾਂ ਤਾਂ ਕਿ ਉਹ ਜਿਹੜੀ ਦਿੱਕਤਾਂ ਨੂੰ ਹੈ ਉਹ ਮੈਂ ਦੂਰ ਕਰ ਸਕਾਂ ਅਤੇ ਜੋ ਜੋ ਬੱਚੇ ਜੋ ਬੱਚੇ ਹੁੰਦੇ ਆ ਉਹ ਛੋਟੇ ਬੱਚੇ ਜਿਹੜੇ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਕੁਛ ਇੰਨਾਂ ਪਤਾ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਇੱਕ ਉਹਨਾਂ ਨੂੰ ਸਿਰਫ ਸੱਚ ਬੋਲਣਾ ਆਉਂਦਾ ਜੋ ਜਿਹੜੇ ਬੱਚੇ ਹੁੰਦੇ ਆ ਉਹ ਉਸ ਇੱਕ ਵੱਡੇ ਹੋ ਕੇ ਉਹੀ ਆਪਣੇ ਸਮਾਜ ਸੰਭਾਲਣਗੇ ਤਾਂ ਕਿਉਂਕਿ ਬੱਚਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਡਿਪਰੈਸ਼ਨ ਕਿਆ ਹੁੰਦਾ ਇਨਜਾਇਟੀ ਕਿਆ ਹੁੰਦਾ ਉਹਨਾਂ ਨੂੰ ਇਹ ਸਾਰੇ ਦਿੱਕਤਾਂ ਵੱਡੇ ਹੋ ਕੇ ਆਉਂਦੀਆਂ ਹੈ ਅਗਰ ਬੱਚੇ ਨੂੰ ਛੋਟੇ ਹੁੰਦੇ ਤੋਂ ਇੱਕ ਵਧੀਆ ਇਨਵਾਇਰਮੈਂਟ ਮਿਲੇ ਇੱਕ ਵਧੀਆ ਇਨ ਇਨਸਾਨ ਮਿਲੇ ਜੋ ਕਿ ਉਹਨਾਂ ਦੀ ਗੱਲ ਸੁਣ ਸਕਦਾ ਸਮਝ ਸਕਦਾ ਤਾਂ ਬੱਚੇ ਇਸ ਇਸ ਐਨਜਾਇਟੀ ਡਿਪਰੈਸ਼ਨ ਵੱਲ ਜਾਣਗੇ ਨਹੀਂ